ਤਾਜ਼ਾ ਖ਼ਬਰਾਂ ਨੂੰ ਯਾਦ ਕਰਕੇ ਜੇਕਰ ਆਪਾਂ ਮੰਨੀਏ ਤਾਂ ਤਾਜ਼ਾ ਖ਼ਬਰਾਂ ਦੇ ਵਿੱਚ ਇਹ ਸਾਡੀ ਜ਼ਿੰਦਗੀ ਦੇ ਬਹੁਤ ਮਹੱਤਵਪੂਰਨ ਪ੍ਰਭਾਵ ਪਾਇਆ ਉਸ 'ਤੇ ਇੱਕ ਜਿਵੇਂ ਕਿ ਸੋਸ਼ਲ ਮੀਡੀਆ ਨੂੰ ਲੈ ਲਈਏ ਆਪਾਂ ਸੋਸ਼ਲ ਮੀਡੀਆ 'ਤੇ ਕੋਈ ਵੀ ਖ਼ਬਰ ਹੈ ਬਹੁਤ ਹੀ ਜਲਦੀ ਨਾਲ ਫੈਲਦੀ ਹੈ ਚਾਹੇ ਉਹ ਇੱਕ ਚੰਗੀ ਖ਼ਬਰ ਹੈ ਚਾਹੇ ਉਹ ਇੱਕ ਬੁਰੀ ਖ਼ਬਰ ਹੈ ਪਰ ਇਸ ਦੇ ਵਿੱਚ ਇਹ ਵੀ ਸੱਚਾਈ ਹੈ ਕਿ ਜੋ ਕਿ ਚੰਗੀਆਂ ਖ਼ਬਰਾਂ ਨੇ ਉਹ ਕਿਤੇ ਨਾ ਕਿਤੇ ਦਬ ਕੇ ਰਹਿ ਜਾਂਦੀਆਂ ਨੇ ਅਤੇ ਬੁਰੀਆਂ ਖ਼ਬਰਾਂ ਉਹਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਅਤੇ ਉਹ ਸ਼ੋਸ਼ਲ ਮੀਡੀਆ 'ਤੇ ਜ਼ਿਆਦਾ ਇੱਕ ਦੂਜੇ ਕੋਲ ਜ਼ਿਆਦਾ ਫੋਰਵਰਡ ਕੀਤੀਆਂ ਜਾਂਦੀਆਂ ਨੇ ਇੱਕ ਦੂਜੇ ਕੋਲ ਜ਼ਿਆਦਾ ਮੇਲ ਰਾਹੀਂ ਵਟਸਐਪ ਰਾਹੀਂ ਭੇਜੀਆਂ ਜਾਂਦੀਆਂ ਨੇ ਜੋ ਕਿ ਸਾਡੀ ਸੋਸਾਇਟੀ ਨੂੰ ਸਾਡੇ ਸਮਾਜ ਨੂੰ ਇੱਕ ਗਲਤ ਰਾਹ ਦਿਖਾਉਂਦੀਆਂ ਨੇ ਅਤੇ ਮੈਂ ਕਹਿਣਾ ਚਾਹੁੰਦਾ ਕਿ ਇਸ ਦੇ ਵਿੱਚ ਜੋ ਆਪਣੀ ਮੀਡੀਆ ਚਾਹੇ ਉਹ ਫੋਨ ਲੈ ਲਓ ਚਾਹੇ ਜੇ ਟੀ ਵੀ ਲੈ ਲਓ ਇਹ ਆਪਣੇ ਸਮਾਜ ਦੇ ਵਿੱਚ ਇੱਕ ਗਲਤ ਪ੍ਰਭਾਵ ਪਾ ਰਹੀਆਂ ਨੇ ਅਤੇ ਲੋਕਾਂ ਦੇ ਦਿਮਾਗਾਂ ਨੂੰ ਕਮਜ਼ੋਰ ਬਣਾ ਰਹੀਆਂ ਨੇ ਇੱਥੋਂ ਤੱਕ ਕਿ ਬਹੁਤ ਲੋਕ ਮਾਨਸਿਕ ਬਿਮਾਰੀ ਦੇ ਵੀ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਉਹਨਾਂ ਦੀ ਨੈਗਟਿਵ ਅ ਉਹਨਾਂ 'ਤੇ ਨੈਗਟੀਵਿਟੀ ਇੰਨਾ ਕੁ ਪ੍ਰਭਾਵ ਕਰ ਜਾਂਦੀ ਹੈ ਕਿ ਉਹ ਪੋਜੀਟਿਵਿਟੀ ਨੂੰ ਸਮਝਣਾ ਹੀ ਭੁੱਲ ਜਾਂਦੇ ਨੇ ਅਤੇ ਉਹ ਮੈਂਟਲੀ ਸਥਿਤੀ ਦੇ ਸ਼ਿਕਾਰ ਹੋ ਜਾਂਦੇ ਨੇ ਧੰਨਵਾਦ